ਆਮ ਤੌਰ 'ਤੇ ਚਿੱਤਰਕਾਰੀ ਕਰਦੇ ਸਮੇਂ ਮੈਂ ਓਇਲ ਪੇਸਟਲ ਵਾਟਰ ਕਲਰ ਜਾਂ ਓਇਲ ਕਲਰ ਵਰਤਦਾ ਹਾਂ ਓਇਲ ਪੇਸਟਲ ਜਾਂ ਫਿਰ ਵਾਟਰ ਕਲਰ ਮੈਂ ਬੋਡੀ ਚੌਂਕ ਤੋਂ ਬਈਏ ਦੀ ਦੁਕਾਨ ਤੋਂ ਲਿਆਉਂਦਾ ਹਾਂ ਕਿਉਂਕਿ ਉਸ ਦੁਕਾਨ ਦਾ ਮਾਲਕ ਮੇਰਾ ਬਹੁਤ ਹੀ ਕਰੀਬੀ ਦੋਸਤ ਹੈ ਜੋ ਕਿ ਮੈਨੂੰ ਜਿਹੜਾ ਸਮਾਨ ਚਾਹੀਦਾ ਹੁੰਦਾ ਹੈ ਸਸਤਾ ਅਤੇ ਵਧੀਆ ਦਿੰਦਾ ਹੈ ਏਸ਼ੀਅਨ ਪੇਂਟ ਮੈਂ ਚਾਰ ਖੰਭੇ ਚੌਕ ਤੋਂ ਇੱਕ ਸਰਦਾਰ ਜੀ ਦੀ ਦੁਕਾਨ ਹੈ ਜੋ ਕਿ ਮੇਰੀ ਜਾਣ ਪਹਿਚਾਣ ਦੇ ਹਨ ਮੈਂ ਉਹਨਾਂ ਕੋਲ ਲਿਆਉਂਦਾ ਹਾਂ ਉਹ ਵੀ ਮੈਨੂੰ ਵਧੀਆ ਅਤੇ ਸਸਤਾ ਸਮਾਨ ਜੋ ਕਿ ਬਹੁਤ ਹੀ ਵਧੀਆ ਹੁੰਦਾ ਹੈ ਉਹ ਦਿੰਦੇ ਹਨ ਆਮ ਤੌਰ 'ਤੇ ਮੈਂ ਸਮਝਦਾ ਹਾਂ ਕਿ ਇਹ ਸਟੇਸ਼ਨਰੀ ਮਹਿੰਗੀ ਨਹੀਂ ਕਿਉਂਕਿ ਇਸ ਤੋਂ ਜੋ ਚੀਜ਼ ਬਣਦੀ ਹੈ ਸਾਡੀ ਚਿੱਤਰਕਾਰੀ ਉਹ ਮਹਿੰਗੀ ਅਤੇ ਅਨਮੋਲ ਹੁੰਦੀ ਹੈ ਉਹ ਚਿੱਤਰਕਾਰੀ ਸਾਡੇ ਮਨ ਨੂੰ ਦਰਸਾਉਂਦੀ ਹੈ ਕਿਉਂਕਿ ਜੋ ਅਸੀਂ ਬਣਾਉਂਦੇ ਹਾਂ ਉਹ ਚਿੱਤਰਕਾਰੀ ਦੇ ਤੌਰ 'ਤੇ ਸਾਡੇ ਮਨ ਦਾ ਸ਼ੀਸ਼ਾ ਬਣ ਜਾਂਦਾ ਹੈ ਅਤੇ ਦਰਸਾਉਂਦਾ ਹੈ ਕਿ ਅਸੀਂ ਕਿੰਨੇ ਕੁ ਅੰਦਰੋਂ ਖੁਸ਼ ਅਤੇ ਵਧੀਆ ਹਾਂ ਜਿਸ ਨਾਲ ਸਾਡੀ ਚਿੱਤਰਕਾਰੀ ਵੀ ਬਹੁਤ ਵਧੀਆ ਬਣਦੀ ਹੈ ਧੰਨਵਾਦ